ਸਾਡੀ ਨਜ਼ਰ ਵਿੱਚ ਵਿਕਸਿਤ ਸੰਸਾਰ ਵਿਕਸਿਤ ਦੇਸ਼ਾਂ ਤੋਂ ਮਿਲ ਕੇ ਬਣਦਾ ਹੈ ਵਿਕਸਿਤ ਦੇਸ਼ ਉਹ ਹਨ ਜਿੱਥੋਂ ਦੇ ਨਾਗਰਿਕ ਆਪਣੇ ਮੁੱਢਲੇ ਅਧਿਕਾਰਾਂ ਤੋਂ ਜਾਣੂ ਹੋਣ ਅਤੇ ਜਿਸ ਦੇਸ਼ ਵਿੱਚ ਨਾਗਰਿਕਾਂ ਨੂੰ ਵਧੀਆ ਸਿਹਤ ਸੇਵਾਵਾਂ ਅਤੇ ਸਿੱਖਿਆ ਸਹੂਲਤਾਂ ਉਪਲਬਧ ਹੋਣ ਕੁਝ ਸਮਿਆਂ ਦੀ ਤੁਲਨਾ ਵਿੱਚ ਅੱਜ ਇੱਕੀਵੀਂ ਸਦੀ ਵਿੱਚ ਦੁਨੀਆ ਬਹੁਤ ਬਦਲ ਗਈ ਹੈ ਯਾਤਾਯਾਤ ਤੋਂ ਲੈ ਕੇ ਇੰਟਰਨੈੱਟ ਸੁਵਿਧਾਵਾਂ ਵਿੱਚ ਕਾਫੀ ਵਿਕਾਸ ਹੋਇਆ ਹੈ ਜੋ ਕਿ ਤਰੱਕੀ ਅਤੇ ਸਫਲਤਾ ਦੀ ਨਿਸ਼ਾਨੀ ਹੈ